ਸਤਿ ਸ਼੍ਰੀ ਅਕਾਲ ਜੀ ਮਹਾਂਮਾਰੀ ਦੀ ਜੇ ਆਪਾਂ ਗੱਲ ਕਰੀਏ ਤਾਂ ਜਿਹੜੀ ਕਰੋਨਾ ਮਹਾਂਮਾਰੀ ਆਈ ਸੀ ਉਦੋਂ ਹਰ ਇੱਕ ਬੰਦਾ ਜਿਹੜਾ ਹੈਗਾ ਉਹ ਅਪ ਆਪ ਆਪਦੇ ਘਰ ਬਹਿਣ ਤੋਂ ਮਜ਼ਬੂਰ ਹੋ ਗਿਆ ਸੀ ਪਾਬੰਦ ਹੋ ਗਿਆ ਸੀ ਬਾਹਰ ਨਹੀਂ ਜਾ ਸਕਦਾ ਸੀ ਅਤੇ ਬਾਹਰ ਜਾਣ ਤੋਂ ਉਹਦੇ 'ਚ ਕਰੋਨਾ ਹੋਣ ਦਾ ਖਤਰਾ ਸੀ ਤਾਂ ਉਸ ਟਾਈਮ ਦੇ ਵਿੱਚ ਸਕੂਲਾਂ ਦੇ ਵਿੱਚ ਜਿਹੜੇ ਸਟ ਵਿਦਿਆਰਥੀ ਪੜ੍ਹਦੇ ਸੀ ਜਾਂ ਪੜ੍ਹਦੇ ਹਨ ਉਹ ਅਤੇ ਕੋਲੇਜ ਦੇ ਵਿੱਚ ਕੋਈ ਵੀ ਜਿਹੜੇ ਵਿਦਿਆਰਥੀ ਸੀਗੇ ਚਾਹੇ ਸਕੂਲ ਦਾ ਹੋਵੇ ਚਾਹੇ ਕੋਲੇਜ ਦਾ ਹੋਵੇ ਸਾਰੇ ਹੀ ਆਪ ਆਪਦੇ ਘਰ ਫਸ ਗਏ ਸੀ ਅਤੇ ਉਹਨਾਂ ਦੀ ਪੜ੍ਹਾਈ ਦੇ ਉੱਤੇ ਵੀ ਇੱਕ ਖਤਰਾ ਆ ਗਿਆ ਸੀ ਵੀ ਉਹਨਾਂ ਦਾ ਸਾਲ ਡਰੋਪ ਹੋਣ ਦਾ ਵੀ ਖਤਰਾ ਪੈ ਗਿਆ ਸੀ ਉਦੋਂ ਡਿਜੀਟਲ ਟੈਕਨੋਲੋਜੀ ਨੇ ਕਾਫੀ ਹੈਲਪ ਕੀਤੀ ਅਤੇ ਡਿਜੀਟਲ ਪਲੇਟਫਾਰਮ ਦੇ ਥਰੂ ਔਨਲਾਈਨ ਕਲਾਸਾਂ ਜੂਮ ਐਪ ਹੋਵੇ ਜਾਂ ਕੋਈ ਵੀ ਅਦਰ ਐਪ ਹੋਵੇ ਉਹਨਾਂ ਦੇ ਥਰੂ ਟੀਚਰ ਨੇ ਇੱਕ ਸਟੂਡੈਂਟ ਨੂੰ ਘਰ ਬੈਠੇ ਵਿਦਿਆਰਥੀ ਨੂੰ ਪਹੁੰਚ ਕੀਤੀ ਅਤੇ ਉਹਨੂੰ ਉਹਦਾ ਉਹਦਾ ਪੜ੍ਹਾਈ ਸੀਗੀ ਉਹਦੀ ਉਹ ਪੂਰੀ ਕਰਵਾਈ ਸਾਲ ਦੀ ਉਹਦੇ ਜਿਹੜੇ ਉਹਦੇ ਪਾਠਕ੍ਰਮ ਵਿੱਚ ਜਿਹੜੇ ਟੋਪਿਕਸ ਸੀਗੇ ਉਹਨੂੰ ਕਰਵਾਏ ਘਰ ਬੈਠੇ ਨੂੰ ਅਤੇ ਉਹਨੂੰ ਟੱਚ ਵਿੱਚ ਰੱਖਿਆ ਪੜ੍ਹਾਈ ਦੇ ਅਤੇ ਕਾਫੀ ਹੈਲਪਫੁਲ ਰਹੀ ਉਹ ਡਿਜੀਟਲ ਟੈਕਨੋਲੋਜੀ ਉਸ ਟਾਈਮ ਦੇ ਵਿੱਚ